ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਕਰ ਸਕਦੇ ਜੀ ਯੋਗਾ ਵੈਸੇ ਤਾਂ ਮੈਂ ਯੋਗਾ ਆਸ਼ਰਮ ਖੁਦ ਟੀਚਰ ਆ ਯੋਗਾ ਕਰਵਾਉਂਦਾ ਤੁਸੀਂ ਜੀ ਉੱਥੇ ਆ ਸਕਦੇ ਜੇ ਤਾਂ ਤੁਹਾਨੂੰ ਬਹੁਤ ਵਧੀਆ ਮੈਂ ਉੱਥੇ ਯੋਗੇ ਦੀਆਂ ਐਕਸਰਸਾਈਜ਼ਾਂ ਹਾਂ ਓਨਲਾਈਨ ਵੀ ਓਨਲਾਈਨ ਵੀ ਅਸੀਂ ਤੁਹਾਨੂੰ ਯੋਗਾ ਕਰਵਾ ਸਕਦੇ ਹਾਂ ਕਰਵਾਉਂਦੇ ਹਾਂ ਅਸੀਂ ਇਹਦੇ ਬਹੁਤ ਫਾਇਦੇ ਨੇ ਤੁਸੀਂ ਜਿਹੜਾ ਨਾ ਅੱਧਾ ਪੌਣਾ ਘੰਟਾ ਇੱਕ ਘੰਟਾ ਤੁਸੀਂ ਓਨਲਾਈਨ ਕਲਾਸ ਅਟੈਂਡ ਕਰ ਸਕਦੇ ਜੀ ਜਿਸ ਤਰ੍ਹਾਂ ਕਿ ਇਹ ਆਪਣੇ ਸਰਵਾਈਕਲ ਦੀਆਂ ਐਕਸਰਸਾਈਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਸਰਵਾਈਕਲ ਅਗਰ ਹੋ ਜਾਵੇ ਤਾਂ ਉਹਦੀਆਂ ਐਕਸਰਸਾਈਜ਼ਾਂ ਇਸ ਟਾਈਪ ਦੀਆਂ ਕਰੀ ਦੀਆਂ ਨੇ ਹਾਂਜੀ ਇਸ ਤੋਂ ਇਲਾਵਾ ਹੋਰ ਜਿਵੇਂ ਆਪਾਂ ਨੂੰ ਕਬਜ਼ ਰਹਿੰਦੀ ਹੈ ਗੋਡੇ ਤੁਸੀਂ ਸਿੱਧੇ ਬੈਠ ਕੇ ਅਤੇ ਬਿਲਕੁਲ ਜਿਹੜੀਆਂ ਪੈਰਾਂ ਦੀਆਂ ਉਂਗਲਾਂ ਨੇ ਇਹਨਾਂ ਨੂੰ ਮੁੱਠੀ ਇਹਨਾਂ ਦੀ ਮੁੱਠੀ ਤਰ੍ਹਾਂ ਇਹਨਾਂ ਨੂੰ ਬੰਦ ਕਰੋ ਛੱਡੋ ਬੰਦ ਕਰੋ ਛੱਡੋ ਇਹ ਐਕਸਰਸਾਈਜ਼ ਜਿਹੜੀ ਡੇਲੀ ਰੋਜ਼ਾਨਾ ਕਰਨ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਗੋਡਾ ਦਰਦ ਨਹੀਂ ਹੋਵੇਗਾ ਹਾਂਜੀ ਗੋਡੇ ਦੀਆਂ ਐਕਸਰਸਾਈਜ਼ਾਂ ਜਿਹੜੀਆਂ ਨੇ ਨਾ ਇਹ ਬਹੁਤ ਹੀ ਵਧੀਆ ਨੇ ਗੋਡੇ ਦੇ ਥੱਲੇ ਹੱਥ ਰੱਖ ਕੇ ਉਵੇਂ ਪੈਰ ਲਾ ਕੇ ਅਤੇ ਗੋਡੇ ਨੂੰ ਉਤਾਂਹ ਚੱਕੋ ਥੱਲੇ ਕਰੋ ਗੋਡੇ ਦੀ ਐਕਸਰਸਾਈਜ਼ ਸਟੋਲ 'ਤੇ ਬੀ ਪੀ ਤਾਂ ਇਸ ਤਰ੍ਹਾਂ ਵੀ ਇਸ ਜਿਹੜੀਆਂ ਐਕਸਰਸਾਈਜ਼ਾਂ ਦੇ ਨਾਲ ਇਹਨਾਂ ਨੂੰ ਹੌਲੀ ਹੌਲੀ ਕਰਨ ਨਾਲ ਬੀ ਪੀ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਦੇ ਵੀ ਨਹੀਂ ਆਉਂਦੀ ਬਟ ਇਹ ਹੈ ਵੀ ਬਹੁਤ ਜ਼ੋਰ ਲਾਉਣ ਵਾਲੀ ਐਕਸਰਸਾਈਜ਼ਾਂ ਨਾ ਕਰੋ ਨੋਰਮਲ ਐਕਸਰਸਾਈਜ਼ਾਂ ਕਰੀ ਚਲੋ ਬੀ ਪੀ ਦੀ ਕਦੇ ਵੀ ਪ੍ਰੋਬਲਮ ਨਹੀਂ ਆਵੇਗੀ ਸ਼ੂਗਰ ਦੀ ਵੀ ਪ੍ਰੋਬਲਮ ਨਹੀਂ ਕਦੇ ਆਵੇਗੀ ਨੋਰਮਲ ਐਕਸਰਸਾਈਜ਼ਾਂ ਨੇ ਸ਼ੂਗਰ ਦੀਆਂ ਵੀ ਬਹੁਤ ਵਧੀਆ ਆਸਣ ਨੇ ਤੁਸੀਂ ਜਿਹੜਾ ਨਾ ਬਹੁਤ ਹੀ ਆਸਾਨੀ ਦੇ ਨਾਲ ਈਜਲੀ ਕਰ ਸਕਦੇ ਜੇ ਗੋਡਿਆ ਦੇ ਯੋਗਾ ਤਾਂ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਇਹਨੂੰ ਜੁਆਇਨ ਕਰੋ ਐਕਸਰਸਾਈਜ਼ਾਂ ਇਹਦੀਆਂ ਨੇ ਬਹੁਤ ਅੱਛੀਆਂ ਅੱਛੀਆਂ ਐਕਸਸਾਈਜ਼ਾਂ ਨੇ ਇਹਨੂੰ ਜੁਇਨ ਕਰੋ ਅਤੇ ਤੁਹਾਨੂੰ ਬਹੁਤ ਹੀ ਵਧੀਆ ਵਧੀਆ ਅਸੀਂ ਐਕਸਰਸਾਈਜ਼ਾਂ ਕਰਵਾਵਾਂਗੇ ਗੋਡਿਆਂ ਦੀਆਂ ਮੋਢਿਆਂ ਦੀਆਂ ਮੋਢਿਆਂ ਦੀਆਂ ਸਰਵਾਈਕਲ ਦੀਆਂ ਅੱਖਾਂ ਦੀਆਂ ਬਹੁਤ ਵਧੀਆ ਐਕਸਰਸਾਈਜ਼ਾਂ ਅਸੀਂ ਓਨਲਾਈਨ ਕਰਵਾਉਂਦੇ ਹਾਂ ਤੁਸੀਂ ਜਦੋਂ ਚਾਹੋ ਜਦੋਂ ਮਰਜ਼ੀ ਮੇਰਾ ਨੰਬਰ ਹੈ ਇਸ ਨੰਬਰ 'ਤੇ ਕੋਂਟੈਕਟ ਕਰਕੇ ਯੋਗਾ ਓਨਲਾਈਨ ਜੁਆਇਨ ਬਿਲਕੁਲ ਜੀ ਬਿਲਕੁਲ ਬਿਲਕੁਲ ਜਦੋਂ ਮਰਜ਼ੀ ਤੁਸੀਂ ਕਾਲ ਕਰਕੇ ਯੋਗਾ ਨਾਲ ਰਿਲੇਟਡ ਜੋ ਵੀ ਜਾਣਕਾਰੀ ਹੈ ਤੁਸੀਂ ਲੈ ਸਕਦੇ ਜੀ ਔਨਲਾਈਨ ਕਰਨਾ ਤਾਂ ਜੇ ਵੈਸੇ ਓਫਲਾਈਨ ਕਰਨਾ ਤਾਂ ਜਿਸ ਤਰ੍ਹਾਂ ਵੀ ਕਰਨਾ ਚਾਹੋ ਅਸੀਂ ਤੁਹਾਡੀ ਪੂਰੀ ਹੈਲਪ ਕਰਨ ਲਈ ਤਿਆਰ ਹਾਂ ਹੋਰ ਹੋਰ ਕੁਛ ਅਤੇ ਨਵੀਆਂ ਤਾਂ ਇਸ ਤਰ੍ਹਾਂ ਵੀ ਇਹ ਐਕਸਰਸਾਈਜ਼ਾਂ ਨੇ ਡੇਲੀ ਇਹਨਾਂ ਨੂੰ ਕਰੋ